ਨਾ ਕੇਵਲ ਪੰਜਾਬ ਬਲਕਿ ਕਿਸੇ ਵੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦਾ ਉਦਯੋਗ ਚਲਾਉਣ ਲਈ ਜਾਂ ਫਿਰ ਉਸਦੇ ਵਿਕਾਸ ਲਈ ਕੁਝ ਮਹੱਤਵਪੂਰਨ ਗੱਲਾਂ ਦਾ ਧਿਆਨ ਹੋਣਾ ਜ਼ਰੂਰੀ ਹੈ ਜਿਵੇਂ ਕਿਸੇ ਵੀ ਉਦਯੋਗ ਨੂੰ ਸਫਲਤਾ ਪੂਰਵਕ ਚਲਾਉਣ ਲਈ ਉਸ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਮ ਲੋਕ ਸਰਕਾਰ ਬਹੁਤ ਹੀ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਇਸ ਤੋਂ ਇਲਾਵਾ ਕਿਸੇ ਵੀ ਉਦਯੋਗ ਨੂੰ ਸਫਲਤਾ ਪੂਰਵਕ ਬਣਾਉਣ ਲਈ ਟੈਕਨੋਲਜੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਟੈਕਨੋਲਜੀ ਜਿਵੇਂ ਇੰਟਰਨੈਟ ਅੱਜ ਦੇ ਸਮੇਂ ਵਿੱਚ ਸਾਡੀ ਆਮ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਇਸ ਤੋਂ ਇਲਾਵਾ ਇੰਟਰਨੈਟ ਨਾ ਕੇਵਲ ਸਾਡੀ ਆਮ ਜ਼ਿੰਦਗੀ ਦਾ ਹਿੱਸਾ ਹੈ ਪਰੰਤੂ ਉਹ ਸਾਡੀ ਆਰਥਿਕ ਆਰਥਿਕ ਜ਼ਿੰਦਗੀ ਦਾ ਵੀ ਹਿੱਸਾ ਬਣ ਚੁੱਕਿਆ ਹੈ ਸਾਡੀ ਅੱਧੇ ਤੋਂ ਵੱਧ ਵਿਕਾਸ ਨੀਤੀ ਕੇਵਲ ਟੈਕਨੋਲਜੀ 'ਤੇ ਹੀ ਨਿਰਭਰ ਹੈ ਇਹ ਟੈਕਨੋਲਜੀ ਸਾਡੇ ਪੰਜਾਬ ਵਿੱਚ ਉਦਯੋਗ ਰਾਹੀਂ ਉਦਯੋਗ ਵਿੱਚ ਵੀ ਵਰਤੀ ਜਾਂਦੀ ਹੈ ਜਿਵੇਂ ਇੰਟਰਨੈਟ ਡਾਟਾ ਆਦਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਦਾ ਹੈ ਨਾ ਕੇਵਲ ਟੈਕਨੋਲਜੀ ਬਲਕਿ ਅਜਿਹੀਆਂ ਕਈ ਹੋਰ ਚੀਜ਼ਾਂ ਹਨ ਜਿਹੜੀ ਕਿ ਕਿਸੇ ਵੀ ਉਦਯੋਗ ਨੂੰ ਸਫਲਤਾ ਪੂਰਨ ਬਣਾਉਣ ਵਿੱਚ ਹਿੱਸਾ ਪਾਉਂਦੀ ਹੈ ਜਿਵੇਂ ਉੱਥੋਂ ਦਾ ਜਲਵਾਯੂ ਮੌਸਮ ਆਦਿ ਅਤੇ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਰਾਹੀਂ ਵੀ ਉਦਯੋਗ ਬਹੁਤ ਪ੍ਰਭਾਵਿਤ ਹੁੰਦਾ ਹੈ ਪਰੰਤੂ ਇਹ ਚੀਜ਼ ਸਾਡੇ ਪੰਜਾਬ ਵਿੱਚ ਨਹੀਂ ਹੈ ਕਿਉਂਕਿ ਸਾਡੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਨਦੀ ਮੰਨਿਆ ਜਾਂਦਾ ਹੈ ਪੰਜਾਬ ਵਿੱਚ ਉਦਯੋਗ ਨੂੰ ਸਥਾਪਿਤ ਕਰਨ ਲਈ ਲੋੜੀਂਦੀਆਂ ਵਸਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਹ ਲੋੜੀਂਦੀਆਂ ਵਸਤਾਂ ਸਾਡੇ ਪੰਜਾਬ ਦੇ ਵਿੱਚ ਪੂਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਪੰਜਾਬ ਦੇ ਉਦਯੋਗ ਨੂੰ ਸਫਲਤਾ ਪੂਰਵਕ ਚਲਾਉਂਦੀਆਂ ਹਨ